ਬਿਜਲੀ ਸਾਡੀ ਜ਼ਿੰਦਗੀ 'ਚ ਬਹੁਤ ਜ਼ਿਆਦਾ ਜ਼ਰੂਰੀ ਹੈ ਬਿਜਲੀ ਤੋਂ ਬਿਨਾਂ ਅਸੀਂ ਕੋਈ ਕੰਮ ਨਹੀਂ ਕਰ ਸਕਦੇ ਬਿਜਲੀ ਨਹੀਂ ਹੋਏਗੀ ਸਾਡੇ ਘਰ ਮੋਟਰ ਨਹੀਂ ਚੱਲੇਗੀ ਬਿਜਲੀ ਨਹੀਂ ਹੋਏਗੀ ਸਾਡੇ ਕੱਪੜੇ ਪ੍ਰੈਸ ਨਹੀਂ ਹੋਣਗੇ ਬਿਜਲੀ ਨਹੀਂ ਹੋਏਗੀ ਤਾਂ ਅਸੀਂ ਮੋਬਾਇਲ ਫੋਨ ਨਹੀਂ ਚਾਰਜ ਸਕਦੇ ਬਿਜਲੀ ਨਹੀਂ ਹੋਏਗੀ ਤਾਂ ਅਸੀਂ ਕੋਈ ਕੰਮ ਨਹੀਂ ਕਰ ਸਕਦੇ ਗਰਮੀ ਵਿੱਚ ਤਾਂ ਬਹੁਤ ਜ਼ਿਆਦਾ ਔਖਾ ਹੁੰਦਾ ਹੈ ਸਾਰਾ ਦਿਨ ਲੈਟ ਨਹੀਂ ਆਉਂਦੀ ਬਿਜਲੀ ਹੋਏਗੀ ਤਾਂ ਸਾਡੇ ਕੰਮ ਹੁੰਦੇ ਹੈ ਬਿਜਲੀ ਬਹੁਤੀ ਜਾਣ ਨਾਲ ਗਰਮੀਆਂ ਵਿੱਚ ਸਾਡੇ ਤਾਂ ਇਨਵੈਟਰ ਵੀ ਡਾਊਨ ਹੋ ਜਾਂਦੇ ਆ ਚਲੋ ਸਰਦੀਆਂ ਵਿੱਚ ਤਾਂ ਧੁੱਪੇ ਬੈਠ ਕੇ ਸਾਡਾ ਗੁਜ਼ਾਰਾ ਹੋ ਜਾਂਦਾ ਰਾਤ ਨੂੰ ਸਾਨੂੰ ਲੈਂਪ ਚਾਰਜ ਕਰ ਕੇ ਰੱਖਣੇ ਪੈਂਦੇ ਆ ਸਾਨੂੰ ਉਹ ਬਾਲਣੇ ਪੈਂਦੇ ਹੈ ਇੱਥੇ ਤਾਂ ਅਸੀਂ ਸੋਲਰ ਲਾਉਣ ਨੂੰ ਫਿਰਦੇ ਹਾਂ ਪਰ ਸੋਲਰ ਲਵਾਲ ਲਵਾਂਵਾਗੇ ਤਾਂ ਬਿਜਲੀ ਦੀ ਫੇਰ ਵੀ ਸਾਨੂੰ ਲੋੜ ਪੈਂਦੀ ਹੈ ਸੋਲਰ ਵੀ ਕਿੰਨੀ ਦੇਰ ਚੱਲਣਗੇ